ਹਾਂਜੀ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਆਪਣੇ ਲੈਦਰ ਬੈਗ ਜਿਹੜਾ ਕਿ ਮੈਂ ਐਮਾਜ਼ੋਨ ਤੋਂ ਲਿਗੇਸੀ ਕੰਪਨੀ ਦਾ ਆਰਡਰ ਕੀਤਾ ਸੀ ਦੋ ਮਹੀਨੇ ਪਹਿਲਾਂ ਅਤੇ ਮੈਂ ਇਸ ਨੂੰ ਕਾਫੀ ਵਰਤਿਆ ਹੈ ਦੋ ਮਹੀਨੇ ਔਰ ਮੈਨੂੰ ਇਹ ਬਹੁਤ ਹੀ ਜ਼ਿਆਦਾ ਸਹੀ ਲੱਗਿਆ ਹੈ ਇਹ ਪ੍ਰੋਡਕਟ ਬਹੁਤ ਹੀ ਅੱਛਾ ਹੈ ਕਿਉਂਕਿ ਇਸ ਦੀ ਜਿਹੜੀ ਕੁਆਲਿਟੀ ਵਾਈਜ਼ ਵੀ ਬਹੁਤ ਅੱਛਾ ਹੈ ਇਸ ਦੇ ਅੰਦਰ ਜੋ ਵੀ ਇਸ ਕਾਫੀ ਜ਼ਿਆਦਾ ਇਸਦੇ ਵਿੱਚ ਸਪੇਸ ਹੈਗੀ ਆ ਔਰ ਇਸ ਦੀਆਂ ਜਿਹੜੀਆਂ ਜ਼ਿੱਪਾਂ ਹੈਗੀਆਂ ਉਹ ਕਾਫੀ ਸਮੂਥਲੀ ਚੱਲਦੀਆਂ ਹਨ ਮਤਲਬ ਕਾਫੀ ਅੱਛਾ ਹੈ ਇਹ ਬੈਗ ਕੁੱਲ ਮਿਲਾ ਕੇ